ਸੱਤ ਜਨਵਰੀ ਦੋ ਹਜ਼ਾਰ ਸੱਤ ਪੰਦਰਾਂ ਜਨਵਰੀ ਦੋ ਹਜ਼ਾਰ ਚੌਵੀ ਅਠਾਈ ਮਾਰਚ ਦੋ ਹਜ਼ਾਰ ਬਾਈ ਪੰਜ ਮਾਰਚ ਦੋ ਹਜ਼ਾਰ ਇੱਕੀ ਇੱਕ ਜਨਵਰੀ ਦੋ ਹਜ਼ਾਰ ਤੇਈ